ਭਾਰਤ ਵਿੱਚ ਭੋਜਨ ਬਹੁਤ ਵਧੀਆ ਅਤੇ ਚੰਗੇ ਹਨ ਜੋ ਕਿ ਅਸੀਂ ਰੋਜ਼ ਆਪ ਬਣਾ ਕੇ ਖਾਂਦੇ ਹਾਂ ਤਾਜੇ ਫਰੈੱਸ਼ ਸਬਜ਼ੀ ਲਿਆਉਂਦੇ ਹਾਂ ਅਤੇ ਰੋਜ਼ ਵਧੀਆ ਢੰਗ ਨਾਲ ਬਣਾ ਕੇ ਖਾਂਦੇ ਹਾਂ ਸਾਫ਼ ਸੁਥਰਾ ਕਰਕੇ ਅਤੇ ਰੋਜ਼ਾਨਾ ਅਸੀਂ ਜੀਵਨ ਵਿੱਚ ਸਬਜ਼ੀ ਬਣਾਉਂਦੇ ਹਾਂ ਫਰੈੱਸ਼ ਸਬਜ਼ੀਆਂ ਬਣਾ ਕੇ ਖਾਂਦੇ ਹਾਂ ਸਾਫ਼ ਸੁਥਰੇ ਬਰਤਨਾਂ ਦੇ ਵਿੱਚ ਸਾਫ਼ ਸੁਥਰਾ ਰੱਖਦੇ ਹਾਂ ਕਿਚਨ ਦਾ ਸਮਾਨ ਅਸੀਂ ਆਪਣੇ ਰਸੋਈ ਦਾ ਸਮਾਨ ਅਤੇ ਅਸੀਂ ਪ੍ਰਸਿੱਧ ਪਕਵਾਨ ਬਣਾਉਂਦੇ ਹਾਂ ਘਰ ਸਰੋਂ ਦਾ ਸਾਗ ਬਣਾਉਂਦੇ ਹਾਂ ਵਧੀਆ ਤਰੀਕੇ ਨਾਲ ਅਤੇ ਨਾਲ ਮੱਕੀ ਦੀ ਰੋਟੀ ਬਣਾਉਂਦੇ ਹਾਂ ਸਰੋਂ ਦੇ ਸਾਗ ਦੇ ਨਾਲ ਵਧੀਆ ਢੰਗ ਨਾਲ ਤਰੀਕੇ ਨਾਲ ਬਣਾ ਕੇ ਖਾਂਦੇ ਹਾਂ ਪਰਿਵਾਰ ਸਮੇਤ ਅਤੇ ਕੁਝ ਪ੍ਰਸਿੱਧ ਮਸਾਲੇ ਅਸੀਂ ਬਾਅਦ 'ਚ ਪਾਉਂਦੇ ਹਾਂ ਜੋ ਕਿ ਅਸੀਂ ਆਪ ਘਰ ਦੇ ਮਸਾਲੇ ਤਿਆਰ ਕਰਦੇ ਹਾਂ ਸੁੱਕੇ ਮਸਾਲੇ ਬਾਜ਼ਾਰੋਂ ਲਿਆ ਕੇ ਘਰ ਅਸੀਂ ਆਪ ਪੀਹ ਕੇ ਉਹਨੂੰ ਮਿਕਸ ਕਰਕੇ ਪੀਹ ਕੇ ਤਿਆਰ ਕਰਦੇ ਹਾਂ ਅਤੇ ਇਹਨਾਂ ਭੋਜਨਾਂ ਵਿੱਚ ਅਸੀਂ ਪਾਉਂਦੇ ਹਾਂ ਵਧੀਆ ਤਰੀਕੇ ਨਾਲ ਅਸੀਂ ਬਣਾ ਕੇ ਰੋਜ਼ ਦੀ ਰੋਜ਼ ਅਸੀਂ ਖਾਂਦੇ ਹਾਂ ਆਪਣੇ ਤੰਦਰੁਸਤ ਰਹਿਣ ਲਈ ਅਸੀਂ ਰੋਜ਼ ਫਰੈੱਸ਼ ਸਬਜ਼ੀ ਖਾਂਦੇ ਹਾਂ